ਤੁਹਾਨੂੰ ਪਤਾ ਹੀ ਆ ਸਰ ਕਿ ਜਿਹੜਾ ਮਿੱਠਾ ਵਾ ਉਹ ਪੰਜਾਬੀਆਂ ਦੀ ਜਾਨ ਅਤੇ ਪੰਜਾਬੀਆਂ ਦਾ ਜਿਹੜਾ ਕੋਈ ਵੀ ਵਿਆਹ ਉਹ ਮਿੱਠੇ ਤੋਂ ਬਿਨਾ ਜਿਹੜਾ ਉਹ ਅਧੂਰਾ ਹੀ ਆ ਮੈਂ ਆਪਣੀ ਸਹੇਲੀ ਦੇ ਨਾਲ ਤੁਹਾਡੀ ਦੁਕਾਨ 'ਤੇ ਬੜੀ ਵਾਰ ਆਈ ਹਾਂ ਔਰ ਬਹੁਤ ਸਾਰੀਆਂ ਮਿਠਾਈਆਂ ਤੁਹਾਡੀ ਦੁਕਾਨ ਦੀਆਂ ਜਿਹੜੀਆਂ ਮੈਂ ਖਾਧੀਆਂ ਨੇ ਔਰ ਕੁਛ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਨੇ ਤੁਹਾਡੀ ਦੁਕਾਨ ਦਾ ਬਣਾਇਆ ਗੁਜੀਆ ਤੁਹਾਡੀ ਦੁਕਾਨ ਦੀਆਂ ਬਣਾਈਆਂ ਜਲੇਬੀਆਂ ਗੁਲਾਬ ਜਾਮੁਨ ਸਾਰੇ ਬਹੁਤ ਵਧੀਆ ਨੇ ਮੇਰੇ ਘਰ ਜਦੋਂ ਵੀ ਕੋਈ ਮਹਿਮਾਨ ਆਉਂਦਾ ਤਾਂ ਮੈਂ ਬਹੁਤ ਵਾਰੀ ਤੁਹਾਡੀ ਦੁਕਾਨ ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਡਰ ਕੀਤੀਆਂ ਨੇ ਅਤੇ ਮੇਰੇ ਮਹਿਮਾਨਾਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਬਹੁਤ ਪਸੰਦ ਨੇ ਮੇਰੇ ਮੁੰਡੇ ਦਾ ਵਿਆਹ ਹੈ ਅਤੇ ਮੇਰੇ ਜਿਹੜੇ ਰਿਸ਼ਤੇਦਾਰ ਨੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹੀ ਚੀਜ਼ਾਂ ਖਵਾਈ ਜੋ ਅਸੀਂ ਤੇਰੇ ਘਰ ਆ ਕੇ ਜਿਹੜੀਆਂ ਨੇ ਉਹ ਖਾਧੀਆਂ ਨੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਇਸ ਲਈ ਮੈਂ ਤੁਹਾਨੂੰ ਇੱਕ ਬੜਾ ਵੱਡਾ ਔਡਰ ਦੇਣ ਲੱਗੀ ਹਾਂ ਮੈਂ ਆਪਣੇ ਮੁੰਡੇ ਦੇ ਵਿਆਹ 'ਤੇ ਜਿੰਨੀਆਂ ਵੀ ਮਿਠਾਈਆਂ ਨੇ ਉਹ ਤੁਹਾਡੀ ਦੁਕਾਨ ਤੋਂ ਹੀ ਜਿਹੜੀਆਂ ਨੇ ਉਹ ਔਡਰ ਕਰਨੀਆਂ ਨੇ ਬੁੱਕ ਕਰਨੀਆਂ ਨੇ ਪਰ ਪਹਿਲਾਂ ਤਾਂ ਸੀ ਕਿ ਆਪਾਂ ਥੋੜ੍ਹੀ ਥੋੜ੍ਹੀ ਮਿਕਦਾਰ ਦੇ ਵਿੱਚ ਸਮਾਨ ਚਲੋ ਮੰਗਵਾਉਂਦੇ ਸੀ ਮਹਿਮਾਨ ਆਏ ਅਤੇ ਕੁਛ ਮੰਗਵਾ ਲਿਆ ਦੂਸਰਾ ਤੁਹਾਡੀ ਦੁਕਾਨ ਦੀ ਸਫਾਈ ਦੇਖ ਕੇ ਔਰ ਤੁਹਾਡੀ ਦੁਕਾਨ ਤੋਂ ਸ਼ੂਗਰ ਫ੍ਰੀ ਜਿਹੜੀ ਮਿਠਆਈ ਉਹ ਵੀ ਜਿਹੜੀ ਹੈ ਉਹ ਮਿਲ ਜਾਂਦੀ ਹੈ ਇਹ ਦੋਨੋਂ ਹੀ ਜਿਹੜੇ ਨੇ ਉਹ ਬਹੁਤ ਵਧੀਆ ਜਿਹੜੇ ਮੈਨੂੰ ਪੁਆਇੰਟ ਲੱਗੇ ਨੇ ਹੁਣ ਆਪਾਂ ਮੁੱਦੇ 'ਤੇ ਆਉਂਦੇ ਹਾਂ ਮੁੱਦੇ ਦੀ ਗੱਲ ਇਹ ਹੈ ਕਿ ਤੁਸੀਂ ਮੈਨੂੰ ਇਹ ਦੱਸੋ ਜ਼ਰਾ ਕਿ ਜਦੋਂ ਇੰਨੀ ਮਿਕਦਾਰ ਦੇ ਵਿੱਚ ਮੈਂ ਤੁਹਾਡੇ ਕੋਲ ਔਡਰ ਬੁੱਕ ਕਰਨ ਲੱਗੀ ਹਾਂ ਅਤੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਉਹਦੇ 'ਤੇ ਕੀ ਪੇਸ਼ਕਸ਼ ਦੇਵੋਗੇ ਕੀ ਔਫਰ ਦੇਵੋਗੇ ਜਿਹਦੇ ਨਾਲ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਅਤੇ ਮੈਨੂੰ ਮੇਰਾ ਵੀ ਲਾਭ ਹੋ ਜਾਵੇ ਤਾਂ ਸਰ ਕਿਰਪਾ ਕਰਕੇ ਤੁਸੀਂ ਮੈਨੂੰ ਇਹ ਦੱਸੋ ਕਿ ਅਗਰ ਮੈਂ ਤੁਹਾਡੇ ਕੋਲੋਂ ਚਾਲੀ ਕਿਲੋ ਜਿਹੜੀ ਮਿਠਆਈ ਹੈ ਉਹ ਬੁੱਕ ਕਰਨੀ ਹੋਵੇ ਤਾਂ ਉਹਦੇ ਉੱਪਰ ਤੁਸੀਂ ਮੈਨੂੰ ਕੀ ਪੇਸ਼ਕਸ਼ ਦੇ ਸਕਦੇ ਹੋ